ਪੰਜਾਬ ਵਿੱਚ ਮੁੱਖ ਸੱਭਿਆਚਾਰਕ ਵਰਜਿਤ ਸਮਾਜਿਕ ਨਿਯਮ ਹੇਠ ਲਿਖੇ ਅਨੁਸਾਰ ਹਨ ਪਾਲਤੂ ਬਿੱਲੀਆਂ ਨੂੰ ਹਿੰਦੂ ਧਰਮ ਵਿੱਚ ਇੱਕ ਬੁਰਾ ਸ਼ ਸ਼ਗਨ ਮੰਨਿਆ ਜਾਂਦਾ ਹੈ ਤੇ ਜੇ ਜੇਕਰ ਬਸ ਜੇਕਰ ਉਹ ਮਨੁੱਖ ਦੇ ਰਸਤੇ ਨੂੰ ਪੂਰਾ ਪਾਰ ਕਰ ਲੈਂਦੀਆਂ ਹਨ ਤਾਂ ਇਸ ਦਾ ਨਤੀਜਾ ਇਹਦਾ ਬਦਕਿਸਮਤ ਹੁੰਦਾ ਹੈ ਅਤੇ ਜਿਸ ਕੰਮ ਲਈ ਵਿਅਕਤੀ ਜਾਂਦਾ ਹੈਗਾ ਹੈ ਤਾਂ ਉਹ ਕੰਮ ਕੰਮ ਨਹੀਂ ਹੁੰਦਾ ਅਸਫਲ ਇ ਇਸ ਵਿੱਚ ਇ ਇੰਗਲੈਂਡ ਵਿੱਚ ਇੱਕ ਕਾਲੀ ਬਿੱਲੀ ਨੂੰ ਇੱਕ ਡੈਨ ਮੰਨਿਆ ਜਾਂਦਾ ਸੀ ਅਤੇ ਪੁਰਾਣੇ ਦਿਨਾਂ ਦਿਨਾਂ ਵਿੱਚ ਦਿਨਾਂ ਵਿੱਚ ਬਹੁਤ ਸਾਰੀਆਂ ਕਾਲੀਆਂ ਬਿੱਲੀਆਂ ਨੂੰ ਡੈਨ ਮੰਨ ਮੰਨਿਆ ਜਾਂਦਾ ਸੀ ਅਤੇ ਇਲ ਇਲਜ਼ਾਮ ਵਿੱਚ ਇਸ ਸੁਰਾਂ ਨੂੰ ਧਰ ਧਰਮਾਂ ਦਾ ਵਰਜਿਤ ਦੁਆਰਾ ਮਾਰਿਆ ਜਾਂਦ ਜਾਂਦਾ ਹੈ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਕਿਸੇ ਵੀ ਮੋੜ 'ਤੇ ਕਿਸੇ ਜੀਵਤ ਜਾਂ